ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੇਰਾ ਨਾਮ ਨਾ ਸਾਡੇ ਫਸਲਾਂ ਦਾ ਕਿੰਨਾ ਨੇ ਸੋਕਾ ਵੀ ਪੈ ਜਾਂਦਾ ਵਾ ਬਦਲਦੇ ਮੌਸਮ 'ਚ ਮੀਂਹ ਆ ਜਾਂਦੇ ਹੈ ਹਨੇਰੀਆਂ ਤੂਫਾਨ ਸਾਡੀਆਂ ਫਸਲਾਂ ਖਰਾਬ ਹੋ ਜਾਂਦੀਆਂ ਕਈ ਵਾਰੀ ਤਾਂ ਉਹ ਹਨੇਰੀਆਂ ਨਾਲ ਹੀ ਹੋ ਜਾਂਦੀ ਆ ਕਈ ਵਾਰੀ ਕਿੰਨਾ ਨੇ ਮੀਂਹ ਇੰਨਾ ਪੈ ਜਾਂਦਾ ਤਾਂ ਖਰਾਬ ਹੋ ਜਾਂਦੀਆਂ ਕਈ ਵਾਰੀ ਕਿੰਨਾ ਨਹੀਂ ਜ਼ਿਆਦਾ ਕਿੰਨਾ ਨਹੀਂ ਉਹ ਹੋ ਜਾਂਦਾ ਧੁੱਪ ਪੈ ਜਾਏ ਤਾਂ ਹੋ ਜਾਂਦੀਆਂ ਕਈ ਵਾਰੀ ਤਾਂ ਕਿੰਨਾ ਨਹੀਂ ਬਹੁਤ ਜ਼ਿਆਦਾ ਕਿੰਨਾ ਨਹੀਂ ਹੋ ਜਾਂਦਾ ਵਾ ਹਨੇਰੀ ਝੱਖੜ ਤੂਫਾਨ ਆ ਜਾਂਦੇ ਤਾਂ ਵੀ ਫਸਲਾਂ ਖਰਾਬ ਹੋ ਜਾਂਦੀਆਂ ਕਈ ਤਾਂ ਉਹ ਕਈ ਹੁੰਦਾ ਵਾ ਵੀ ਕਿੰਨਾ ਵਿਚਾਰੇ ਕਿਸਾਨ ਕੀ ਕਰਨ ਵਿਚਾਰੇ ਉਹਨਾਂ ਵਿਚਾਰਿਆਂ ਨੇ ਤਾਂ ਦ ਦਿਨ ਰਾਤ ਇੱਕ ਕਰਕੇ ਉਹਨਾਂ ਨੇ ਕਰਦੇ ਹੈ ਵਿਚਾਰੇ ਉਹਨਾਂ ਦਾ ਕੁਛ ਨਹੀਂ ਹੁੰਦਾ ਉਹ ਕਈ ਵਾਰੀ ਫਿਰ ਵਿਚਾਰੇ ਪਛਤਾਉਂਦੇ ਆ ਕੀ ਕਰਨ ਵਿਚਾਰੇ ਉਹਨਾਂ ਦਾ ਇਹ ਵਾ ਵੀ ਕਿੰਨਾ ਨਹੀਂ ਕਈ ਵਾਰੀ ਉਹਨਾਂ ਨੂੰ ਹੋ ਜਾਂਦਾ ਵੀ ਚੱਲ ਜੇ ਸਰਕਾਰ ਨਾਲ ਵੀ ਲੜਦੇ ਆ ਸਰਕਾਰ ਨੂੰ ਵੀ ਕਹਿੰਦੇ ਆ ਰੋਂਦੇ ਆ ਉਹਨਾਂ ਦੇ ਅੱਗੇ ਵੀ ਸਾਡੀ ਫਸਲ ਖਰਾਬ ਹੋ ਗਈ ਹੈ ਸਾਨੂੰ ਕੁਛ ਦੇ ਦਿਓ ਕੁਛ ਕਰੋ ਸਾਡਾ ਵੀ ਦੇਖੋ ਸੋਚੋ ਕੁਛ ਘਰ ਦਾ ਅਸੀਂ ਵੀ ਕਿੱਦਾਂ ਆਪਾਂ ਕਰਨਾ ਅਤੇ ਉਹ ਵੀ ਕਿੰਨਾ ਕੁ ਦੇਣਾ ਉਹਨਾਂ ਨੇ ਉਹਨਾਂ ਨੇ ਵੀ ਆਪਣੇ ਹਿਸਾਬ ਦੇ ਨਾਲ ਹੀ ਲ ਕਰਨਾ ਵਾ ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਦੇਣਾ ਵਾ ਉਹਨਾਂ ਨੂੰ ਔਰ ਕੀ ਕਰਨਾ ਫਿਰ ਹੁਣ ਜੇ ਇਹ ਹੁੰਦਾ ਜੇ ਫਸਲ ਖਰਾਬ ਹੋਜੇ ਫਿਰ ਕਿੰਨਾ ਨਹੀਂ ਕਣਕ ਵੀ ਘੱਟ ਜਾਣੀ ਹੈ ਉਹ ਵੀ ਕਿੰਨਾ ਨਹੀਂ ਚੌਲ ਕਣਕ ਫਿਰ ਘੱਟ ਹੀ ਫਿਰ ਹੁੰਦੇ ਆ ਕਈ ਜਿਹੜੇ ਖਰਾਬ ਹੋ ਜਾਂਦੇ ਕਈ ਜਿਹੜੇ ਮਾੜੇ ਮੋਟੇ ਬਚ ਜਾਂਦੇ ਹੈ ਉਹ ਫਿਰ ਕਿੰਨਾ ਨਹੀਂ ਹੋ ਜਾਂਦਾ ਜੀ ਅਤੇ ਕੀ ਕਰਨਾ ਕਿੰਨਾ ਨਹੀਂ ਉਹਨਾਂ ਦਾ ਇਹ ਵਾ ਵੀ ਕਿੰਨਾ ਨਹੀਂ ਫਸਲਾਂ ਦਾ ਬਹੁਤ ਮਾੜਾ ਹਾਲ ਹੋ ਜਾਂਦਾ ਬਹੁਤ ਜ਼ਿਆਦਾ ਮਾੜਾ ਹਾਲ ਹੋ ਜਾਂਦਾ ਅਤੇ ਉਹ ਗੋਰਮੈਂਟ ਨੂੰ ਕਹਿੰਦੇ ਹੈ ਵਿਚਾਰੇ ਰੋਂਦੇ ਕਰਲਾਉਂਦੇ ਹੈ ਧਰਨੇ ਦਿੰਦੇ ਹੈ ਇੱਦਾਂ ਕਰਦੇ ਹੈ ਵੀ ਸਾਨੂੰ ਸੋਚੋ ਸਾਡਾ ਸਰਕਾਰ ਵੀ ਤੁਹਾਨੂੰ ਪਤਾ ਹੀ ਆ ਕੀ ਸੋਚਣਾ ਉਹਨਾਂ ਨੇ ਵਿਚਾਰਿਆਂ ਜੋ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਓਨਾ ਥੋੜ੍ਹੀ ਉਹਨਾਂ ਨੇ ਦੇਣਾ ਵਾ ਓਨਾ ਨਹੀਂ ਦਿੰਦੇ ਉਹ ਕਿੰਨਾ ਨਹੀਂ ਜੋ ਜੋ ਮਾੜਾ ਮੋਟਾ ਦਿੰਦੇ ਹੋਣਗੇ ਮਾੜਾ ਮੋਟਾ ਹਾਂਜੀ